ਪਟਿਆਲਾ ਇੱਕ ਬਾਬਾ ਪੱਟੀ ਕਾ ਆਲਾ ਨਾਮ ਵਿਕਸਿਤ ਹੋਇਆ ਜਿਸਦਾ ਬਾਬੇ ਦਾ ਨਾਮ ਸੀ ਆਲਾ ਸਿੰਘ ਜਿਸ ਤੋਂ ਨਾਮ ਬਣਿਆ ਆਲਾ ਕੀ ਪੱਟੀ ਅਤੇ ਪੱਟੀ ਤੋਂ ਬਦਲ ਕੇ ਮੂਰੇ ਆ ਕੇ ਪਟਿਆਲਾ ਸ਼ਬਦ ਬਣਿਆ ਇਹ ਬਹੁਤ ਹੀ ਪੁਰਾਣਾ ਸ਼ਹਿਰ ਹੈ ਅਤੇ ਸ਼ਾਹੀ ਸ਼ਹਿਰ ਹੈ ਪੰਜਾਬ ਪ੍ਰਦੇਸ਼ ਦਾ ਇਸ ਦੀਆਂ ਪ੍ਰਮੁੱਖ ਘਟਨਾਵਾਂ ਜਿਵੇਂ ਕਿ ਇੱਥੇ ਕਈ ਤਰ੍ਹਾਂ ਦੇ ਮਹਾਰਾਜੇ ਹੋਏ ਹਨ ਜਿਨ੍ਹਾਂ ਨੇ ਆਪਣਾ ਰਾਜ ਵਿਕਸਿਤ ਕੀਤਾ ਹੈ ਅਤੇ ਪੰਜਾਬ ਦੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਹੁਤ ਸਾਥ ਦਿੱਤਾ ਹੈ ਅਤੇ ਇਸ ਨੂੰ ਵਿਕਸਿਤ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਕਈ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਉਹ ਰਾਜ ਘਰਾਣੇ ਦੇ ਬਹੁਤ ਹੀ ਪ੍ਰਸਿੱਧ ਮੰਤਰੀ ਹਨ ਅਤੇ ਉਹ ਕੈਪਟਨ ਐਜ਼ ਆ ਇੰਡੀਅਨ ਆਰਮੀ ਵਿੱਚ ਵੀ ਰਹੇ ਹਨ